ਇੱਛਾ ਰੱਖੀਏ ਜਾਂ ਆਪਣਾ ਗੋਲ ਹੋਵੇ ਤਾਂ ਫਿਲਹਾਲ ਤਾਂ ਇਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਪਰ ਉਂਝ ਖੁਦ ਲਗਾਉਣਾ ਪਸੰਦ ਆ ਅਤੇ ਖੁਦ ਲਈ ਕਦੇ ਕਦੇ ਆਪਣੇ ਲਈ ਸ਼ੌਂਕ ਲਈ ਗਾਣੇ ਗਾਉਣਾ ਵਧੀਆ ਲੱਗਦਾ ਆ ਪੰਜਾਬੀ ਗਾਣੇ ਹਿੰਦੀ ਗਾਣੇ ਜਿਹੜੇ ਵੀ ਹੋਣ ਵਧੀਆ ਲੱਗਦੇ ਆ ਸੁਣਨੇ ਫਿਰ ਉਹਨਾਂ ਨੂੰ ਗਾਉਣਾ ਪਸੰਦ ਆ ਪਰ ਫਿਲਹਾਲ ਇਵੇਂ ਦੀ ਕੋਈ ਵੀ ਹੈ ਨਹੀਂ ਮੇਰੇ ਮਨ ਦੇ ਵਿੱਚ ਖਿਆਲ ਕਿਉਂਕਿ ਹਜੇ ਮੈਂ ਆਪਣੀ ਪੜ੍ਹਾਈ ਨਾਲ ਪੜ੍ਹਾਈ ਵੱਲ ਹੀ ਫੋਕਸ ਕਰ ਰਹੀ ਹਾਂ ਸੋ ਫਿਲਹਾਲ ਤਾਂ ਇੱਕ ਵਾਰੀ ਮੇਰੇ ਮਨ ਦੇ ਵਿੱਚ ਇਵੇਂ ਦੀ ਕੋਈ ਵੀ ਇੱਛਾ ਨਹੀਂ ਹੈਗੀ ਪਰ ਹਾਂ ਜੇ ਕਦੀ ਭਵਿੱਖ 'ਚ ਮੌਕਾ ਮਿਲੇ ਤਾਂ ਚਲੋ ਆਪਾਂ ਕਰ ਸਕਦੇ ਹਾਂ ਪਰ ਬਾਕੀ ਫਿਲਹਾਲ ਤਾਂ ਨਹੀਂ ਹੈਗੀ ਇਵੇਂ ਦੀ ਕੋਈ ਵੀ ਮੇਰੀ ਖੁਆਇਸ਼